ਪੰਜਾਬ ਵਿੱਚ ਬਹੁਤ ਹੀ ਤਰ੍ਹਾਂ ਦੇ ਸਿਹਤ ਸੰਭਾਲ ਕਰਮਚਾਰੀ ਹਨ ਜਿੱਦਾਂ ਕਿ ਨਰਸ ਹੋ ਗਏ ਡਾਕਟਰ ਹੋ ਗਿਆ ਸਪੈਸ਼ਲਿਸਟ ਹੋ ਗਏ ਅੱਖਾਂ ਦੇ ਦਿਲ ਦੇ ਫੇਫੜਿਆਂ ਦੇ ਅਤੇ ਕਈ ਤਰ੍ਹਾਂ ਦੇ ਐਕਸਰੇ ਕਰਨ ਵਾਲੇ ਸਪੈਸ਼ਲਿਸਟ ਵੀ ਬਹੁਤ ਹੀ ਆਸਾਨੀ ਦੇ ਨਾਲ ਮਿਲ ਜਾਂਦੇ ਹਨ ਜਿੱਦਾਂ ਕਿ ਅਸੀਂ ਦੇਖ ਰਹੇ ਹਾਂ ਕਿ ਰਾਜ ਵਿੱਚ ਸਿਹਤ ਸੰਭਾਲ ਪੇਸ਼ਾਵਰਾਂ ਨੂੰ ਕੁਝ ਕੁ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜਿੱਦਾਂ ਕਿ ਕਈ ਵਾਰ ਜੋ ਬਹੁਤ ਹੀ ਜ਼ਿਆਦਾ ਪੜ੍ਹੇ ਲਿਖੇ ਸਪੈਸ਼ਲਿਸਟ ਹੁੰਦੇ ਹਨ ਉਹਨਾਂ ਨੂੰ ਬਹੁਤ ਹੀ ਘੱਟ ਤਨਖਾਹਾਂ ਮਿਲਦੀਆਂ ਹਨ ਜਾਂ ਫਿਰ ਕਈ ਵਾਰ ਇੰਝ ਹੋ ਜਾਂਦਾ ਹੈ ਕਿ ਉਹਨਾਂ ਦੀ ਪੋਸਟਿੰਗ ਜੋ ਹੈ ਬਹੁਤ ਦੂਰ ਦੇ ਇਲਾਕਿਆਂ ਦੇ ਵਿੱਚ ਹੋ ਜਾਂਦੀ ਹੈ ਜਿਸ ਨਾਲ ਕਿ ਉਹਨਾਂ ਨੂੰ ਆਪਣੇ ਜੋ ਉਹਨਾਂ ਦਾ ਘਰ ਹੁੰਦਾ ਹੈ ਉੱਥੋਂ ਛੱਡ ਕੇ ਕਿਸੇ ਦੂਸਰੀ ਥਾਂ 'ਤੇ ਜਾ ਜਾਣਾ ਮੁਸ਼ਕਲ ਹੋ ਜਾਂਦਾ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਕੋਲਜ ਹੁੰਦੇ ਆ ਉਹਨਾਂ ਦੇ ਵਿੱਚ ਜਦੋਂ ਬੱਚੇ ਪੜ੍ਹਦੇ ਹਨ ਤਾਂ ਉਹਨਾਂ ਨੂੰ ਬਹੁਤ ਵਧੀਆ ਜੋ ਹੈ ਇੱਕ ਸਿਖਲਾਈ ਦੇ ਦਿੱਤੀ ਜਾਂਦੀ ਹੈ ਕਿਉਂਕਿ ਜਿਸ ਤਰ੍ਹਾਂ ਬੱਚੇ ਪੜ੍ਹ ਰਹੇ ਹੁੰਦੇ ਆ ਨਾਲ ਦੀ ਨਾਲ ਉਹਨਾਂ ਨੂੰ ਪ੍ਰੈਕਟੀਕਲ ਵੀ ਕਰਵਾ ਦਿੱਤੇ ਜਾਂਦੇ ਹਨ ਸੋ ਇਸ ਤਰ੍ਹਾਂ ਉਹਨਾਂ ਨੂੰ ਆਪਣੀ ਜੋ ਖੇਤਰ ਹੈ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਜਾਣਕਾਰੀ ਹੋ ਜਾਂਦੀ ਹੈ ਜਦੋਂ ਅਸੀਂ ਚੁਣੌਤੀਆਂ ਦੀ ਗੱਲ ਕਰਦੇ ਹਾਂ ਤਾਂ ਇਹ ਆ ਸਕਦਾ ਹੈ ਕਿ ਕਈ ਬੱਚੇ ਇਸ ਖੇਤਰ ਨੂੰ ਨਹੀਂ ਚੁਣਦੇ ਕਿਉਂਕਿ ਉਹਨਾਂ ਨੂੰ ਇਹ ਖੇਤਰ ਦੇ ਵਿੱਚ ਪੜ੍ਹਾਈ ਕਰਨੀ ਥੋੜ੍ਹੀ ਮੁਸ਼ਕਲ ਲੱਗਦੀ ਹੈ